ਸਤਿ ਸ਼੍ਰੀ ਅਕਾਲ ਦੀਦੀ ਹਾਂਜੀ ਵਧੀਆ ਠੀਕ ਹੈ ਤੁਸੀਂ ਸੁਣਾਓ ਕੀ ਹਾਲ ਚਾਲ ਹੈ

ਹਾਂਜੀ ਦੀਦੀ ਹਾਂਜੀ ਹਾਂਜੀ ਠੀਕ ਏ ਹਾਂਜੀ ਹਾਂਜੀ ਦੀਦੀ ਜੀ ਬਣਾ ਦਾਂਗੇ ਤੁਸੀਂ ਆਪਣਾ ਮੈਨੂੰ ਨਾਪ ਦੇ ਜਾਣਾ ਤੇ ਨਾਪ ਦੇ ਦੇਣਾ ਤੇ ਤੁਸੀਂ ਜਿਸ ਤਰ੍ਹਾਂ ਦਾ ਦੀਦੀ ਬਣਾਣਾ ਤੇ ਤੁਸੀਂ ਉਸ ਤਰ੍ਹਾਂ ਦਾ ਮੈਨੂੰ ਡਿਜ਼ਾਇਨ ਦੱਸ ਦੋ ਕਿ ਕਿਸ ਤਰ੍ਹਾਂ ਤੁਸੀਂ ਡਿਜ਼ਾਇਨ ਬਣਵਾਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਦੀਦੀ ਮੈਂ ਤੁਹਾਡਾ ਲਹਿੰਗਾ ਤਿਆਰ ਕਰ ਦੇਵਾਂਗੀ ਤੇ ਤੁਸੀਂ ਮੈਨੂੰ ਲੈਸ ਲੈ ਕੇ ਦੇ ਦੇਣਾ ਜਿਹੜਾ ਜਿਹੜਾ ਸਮਾਨ ਤੁਸੀਂ ਲਾਣਾ ਤੇ ਜੇ ਤੁਸੀਂ ਨਹੀਂ ਮੈਂ ਫਿਰ ਉਹਦੇ ਕੋਲੋ ਲਿਆ ਕੇ ਤੁਹਾਨੂੰ ਤਿਆਰ ਕਰਕੇ ਦੇ ਦੇਵਾਂਗੇ ਫਿਰ ਮੈਂ ਤੇ ਉਹ ਤੁਸੀਂ ਜਿਵੇਂ ਹਾਂਜੀ ਜੇ ਤੁਸੀਂ ਕੀ ਆਪ ਲਿਆ ਦੋ ਤੇ ਵਧੀਆ ਤੇ ਜੇ ਨਹੀਂ ਤੇ ਫਿਰ ਤੁਸੀਂ ਮੈਨੂੰ ਦੱਸ ਦੋ ਮੈਂ ਤੁਹਾਨੂੰ ਆਪੇ ਹੀ ਲਿਆ ਕੇ ਤੁਹਾਡਾ ਲਹਿੰਗਾ ਸਾਰਾ ਤਿਆਰ ਕਰਕੇ ਤੁਹਾਨੂੰ ਮੈਂ ਫੋਨ ਕਰ ਦਿਆਂਗੀ ਹਾਂਜੀ ਹਾਂਜੀ ਕੋਈ ਗੱਲ ਨੀ ਮੈਂ ਲਿਆਵਾਂਗੇ ਤੁਹਾਡੀ ਲੈਸ ਵੀ ਤੇ ਉਸ ਨੂੰ ਤੁਸੀਂ ਦੱਸੋ ਵੀ ਲਟਕ ਵਗੈਰਾ ਵੀ ਤੁਸੀਂ ਲਗਾਉਣੇ ਉਹਨਾਂ ਨੂੰ ਕਿ ਨਹੀਂ ਹਾਂਜੀ ਹਾਂਜੀ ਤੇ ਤੁਸੀਂ ਇਹਦੇ ਨਾਲ ਬਲਾਓਜ ਛੋਟਾ ਸਿਉਣਾ ਏ ਕਿ ਥੋੜਾ ਜਿਹਾ ਲੌਂਗ ਚ ਸ਼ ਵੀ ਬਣਾਉਣਾ ਏ ਠੀਕ ਹੈ ਹਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਹਾਂਜੀ ਠੀਕ ਹ ਜੀ ਤੇ ਬਾਕੀ ਤੁਸੀਂ ਜਿਸ ਤਰ੍ਹਾਂ ਦਾ ਵੀ ਗਲਾਂ ਡਿਜਾਇਨ ਅਗਲਾ ਜਾਂ ਪਿਛਲਾ ਗਲਾ ਕਿਸੇ ਵੀ ਤਰ੍ਹਾਂ ਦਾ ਜਾਂ ਲਹਿੰਗੇ ਤੇ ਕੋਈ ਵੀ ਡਿਜਾਇਨ ਪਾਉਣਾ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਲਗਾ ਦਿਓ ਜੀ ਇਹ ਠੀਕ ਹਾਂਜੀ ਕੋਈ ਗੱਲ ਨਹੀਂ ਜੀ ਤੁਸੀਂ ਤਾਂ ਨਾ ਆਪਣਾ ਜਦੋਂ ਲਹਿੰਗਾ ਭੇਜੋਗੇ ਨਾਲ ਨਾਪ ਜਰੂਰ ਭੇਜ ਦੇਣਾ ਤੇ ਇਦਾਂ ਦੇ ਭੇਜਣਾ ਨਾ ਤੇ ਉਹਨਾਂ ਦਾ ਨਾਪ ਜਰੂਰ ਵਿੱਚ ਹੋਏ ਕਿਉਂਕਿ ਆਪਾਂ ਫਿਟਿੰਗ ਬਣਾ ਸਕੀਏ ਹਾਂਜੀ ਕੋਈ ਗੱਲ ਨਹੀਂ ਸੀ ਅਸੀਂ ਬਣਵਾ ਦਾਂਗੇ ਤੇ ਤੁਸੀਂ ਸਾਰੇ ਮੈਨੂੰ ਦੇ ਜਾਣਾ ਤੇ ਮੈਂ ਫਿਰ ਤੁਹਾਡੇ ਸਾਰੇ ਤਿਆਰ ਕਰਕੇ ਤੁਹਾਨੂੰ ਫੋਨ ਕਰ ਦਾਂਗੀ ਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਤੁਹਾਡਾ ਸਤਾਈ ਜਨਵਰੀ ਨੂੰ ਹਾਂਜੀ ਤੁਸੀਂ ਮੈਨੂੰ ਪਹਿਲਾਂ ਦੇ ਜਾਣਾ ਤੇ ਉਹ ਮੈਂ ਤੁਹਾਡੇ ਨਾਲ ਉਹ ਵੀ ਸਟਿਚ ਕਰਵਾ ਕੇ ਤੇ ਤੁਹਾਨੂੰ ਤਿਆਰ ਕਰਕੇ ਦੇ ਦਾਂਗੀ ਹਾਂਜੀ ਹਾਂਜੀ ਉਹ ਫਿਰ ਕੱਠੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੁਸੀਂ ਮੈਨੂੰ ਸੂਟ ਦੇ ਜਾਨਾ ਫਿਰ ਮੈਂ ਸੂਟ ਦੇਖ ਕੇ ਤੇ ਸਾਰਾ ਲਹਿੰਗੇ ਤੇ ਸਾਰਾ ਮਟੀਰੀਅਲ ਵਗੈਰਾ ਲਾ ਕੇ ਫਿਰ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿਆਂਗੀ ਤੁਹਾਡੀ ਪੇਮੈਂਟ ਕਿੰਨੀ ਬਣੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ